ਪੰਜਾਬ ਇੱਕ ਹਰਾ ਭਰਾ ਰਾਜ ਹੈ ਮੁੱਢ ਤੋਂ ਹੀ ਪੰਜਾਬ ਅਤੇ ਪੰਛੀਆਂ ਦਾ ਬਹੁਤ ਪੁਰਾਣਾ ਨਾਤਾ ਹੈ ਪੰਜਾਬ ਵਿੱਚ ਕਈ ਪ੍ਰਕਾਰ ਦੇ ਪੰਛੀ ਪਾਏ ਜਾਂਦੇ ਹਨ ਇਹਨਾਂ ਵਿੱਚ ਕੁਝ ਪ੍ਰਵਾਸੀ ਹੁੰਦੇ ਹਨ ਅਤੇ ਕੁਝ ਘਰੇਲੂ ਪੰਛੀ ਪੰਜਾਬ ਖੇਤਰ ਵਿੱਚ ਘੁੱਗੀਆਂ ਗਿਟਾਰਾਂ ਚਿੜੀਆਂ ਕਾਂ ਅਤੇ ਕਬੂਤਰ ਆਮ ਹੀ ਵੇਖੇ ਜਾ ਸਕਦੇ ਹਨ ਇਹਨਾਂ ਸਾਰਿਆਂ ਵਿੱਚੋਂ ਮੇਰੀ ਪਸੰਦੀਦਾ ਕਿਸਮ ਗੋਲੇ ਕਬੂਤਰ ਹਨ ਇਹ ਬਹੁਤ ਹੀ ਭੋਲੇ ਹੁੰਦੇ ਹਨ ਇਹ ਰੰਗ ਦੇ ਕਾਲੇ ਜਾਂ ਫਿਰ ਸਲੇਟੀ ਹੁੰਦੇ ਹਨ ਇਹ ਆਪਣਾ ਆਲ੍ਹਣਾ ਰੁੱਖਾਂ ਘਰਾਂ ਦੀਆਂ ਖਿੜਕੀਆਂ ਅਤੇ ਰੌਸ਼ਨਦਾਨਾਂ ਵਿੱਚ ਬਣਾਉਂਦੇ ਹਨ ਇਹ ਮੇਰਾ ਮਨਭਾਉਂਦਾ ਪੰਛੀ ਇਸ ਕਰਕੇ ਹਨ ਕਿਉਂਕਿ ਇਹ ਆਜ਼ਾਦ ਰਹਿਣਾ ਪਸੰਦ ਕਰਦੇ ਹਨ ਅਤੇ ਇਹ ਆਤਮ ਨਿਰਭਰ ਹੁੰਦੇ ਹਨ ਇਹ ਨਾ ਤਾਂ ਚੋਗੇ ਲਈ ਕਿਸੇ 'ਤੇ ਨਿਰਭਰ ਹੁੰਦੇ ਹਨ ਅਤੇ ਨਾ ਹੀ ਸ਼ਿਕਾਰ ਲਈ